ਹਾਂ ਮੈਂ ਅੱਥਰੀ ਬੱਸ ਦਾ ਕਾਫੀ ਹੱਦ ਤੱਕ ਵਰਣਨ ਕਰ ਸਕਦਾ ਹਾਂ ਹਾਂ ਮੈਂ ਯਾਤਰੀ ਬਸ ਇੱਕ ਵਾਰੀ ਸਫਰ ਕੀਤਾ ਹੈ ਉਦੋਂ ਮੇਰੀਆਂ ਗਰਮੀਆਂ ਦੀਆਂ ਛੁੱਟੀਆਂ ਸੀਗੀਆਂ ਮੇਰੇ ਡੈਡੀ ਕਹਿੰਦੇ ਕਿ ਆਪਾਂ ਵੈਸ਼ਨੋ ਦੇਵੀ ਜਾਵਾਂਗੇ ਵੈਸ਼ਨੋ ਦੇਵੀ ਅਸੀਂ ਜਾਣ ਵਾਸਤੇ ਸਾਰਿਆਂ ਨੇ ਬਹਿ ਕੇ ਸੋਚਿਆ ਜੋਇੰਟ ਫੈਮਲੀ ਆ ਸਾਡੀ ਜੋਇੰਟ ਫੈਮਲੀ 'ਚ ਸਾਰਿਆਂ ਨੇ ਬਹਿ ਕੇ ਸੋਚਿਆ ਕਿ ਬੱਸ 'ਤੇ ਜਾਵਾਂਗੇ ਬੱਸ 'ਚ ਸਾਰੇ ਮੌਜ ਮਸਤੀ ਕਰਦੇ ਜਾਵਾਂਗੇ ਇੱਕ ਦੂਜੇ ਨਾਲ ਖੇਡਦੇ ਜਾਵਾਂਗੇ ਗੇਮਾਂ ਖੇਡਦੇ ਜਾਵਾਂਗੇ ਨੱਚਦੇ ਜਾਵਾਂਗੇ ਟੱਪਦੇ ਜਾਵਾਂਗੇ ਹੈ ਨਾ ਉਦੋਂ ਫਿਰ ਅਸੀਂ ਰਸਮ 'ਤੇ ਵੀ ਗਏ ਸੀ ਫਿਰ ਬੱਸ ਅਸੀਂ ਕੀਤੀ ਸੀਗੀ ਟਰੈਵਲਰ ਬਸ ਕੀਤੀ ਸੀ ਅਸੀਂ ਟਰੈਵਲਰ ਬੱਸ ਸੀਗੀ ਜਿਹੜੀ ਕਾਫੀ ਕੰਫਰਟੇਬਲ ਸੀਗੀ ਸੀਟਾਂ ਜਿਹੜੀਆ ਹੈਗੀਆਂ ਉਹਦੀਆਂ ਬਹੁਤ ਜ਼ਿਆਦਾ ਕੰਫਰਟੇਬਲ ਸੀਗੀਆਂ ਹੈ ਨਾ ਜਿਵੇਂ ਐਂਡ ਵਾਲੀ ਜਿਹੜੀ ਸੀਟ ਹੁੰਦੀ ਹੈ ਉੱਥੇ ਸੀਟ ਦੀ ਥਾਂ 'ਤੇ ਇੱਕ ਬੈਡ ਲੱਗਿਆ ਹੋਇਆ ਸੀ ਹੈ ਨਾ ਬੈਡ ਲੱਗਿਆ ਹੋਇਆ ਸੀ ਅਤੇ ਹਰ ਜਿਹੜੀ ਸੀਟ ਹੈਗੀ ਆ ਉਹਦੇ ਉੱਤੇ ਸੀਗੀ ਸੈਟਿੰਗ ਸੀਗੀ ਆਪਾਂ ਏ ਸੀ ਚਲਾ ਸਕਦੇ ਸੀ ਬੰਦ ਕਰ ਸਕਦੇ ਸੀ ਘੱਟ ਕਰ ਸਕਦੇ ਸੀ ਵੱਧ ਵਧਾ ਕਰਾ ਆਪਦੀ ਮਰਜ਼ੀ ਨਾਲ ਆਪਾਂ ਜਿਵੇਂ ਮਰਜ਼ੀ ਕਰ ਸਕਦੇ ਸੀ ਹੈ ਨਾ ਸੀਟਾਂ ਖੁੱਲ੍ਹੀਆਂ ਡੁੱਲ੍ਹੀਆਂ ਆਰਾਮ ਨਾਲ ਜਿਵੇਂ ਮਰਜ਼ ਬਹਿ ਸਕਦੇ ਸੀ ਹੈ ਨਾ ਬਸ ਖੁੱਲ੍ਹੀ ਸੀਗੀ ਵਿੱਚ ਨੱਚ ਸਕਦੇ ਸੀ ਗੇਮਾਂ ਖੇਡ ਸਕਦੇ ਸੀਗੇ ਇੱਕ ਦੂਜੇ ਨਾਲ ਆਰਾਮ ਨਾਲ ਉਵੇਂ ਗੱਲਬਾਤ ਕਰ ਸਕਦੇ ਸੀ ਸਾਰਿਆਂ ਤੋਂ ਅੱਗੇ ਡਰਾਈਵਰ ਦੀ ਸੀਟ ਸੀਗੀ ਡਰਾਈਵਰ ਦੀ ਸੀਟ ਵੀ ਇਕਦਮ ਵਧੀਆ ਸੀ ਬਸ 'ਚ ਉਹਨਾਂ ਨੇ ਡਸਟਬੀਨ ਰੱਖਿਆ ਹੋਇਆ ਸੀਗਾ ਕਿ ਬਸ ਗੰਦੀ ਨਾ ਹੋਵੇ ਬਸ ਦੇ ਥੱਲੇ ਮੈਟਰਸ ਉਹਨਾਂ ਨੇ ਆਪਦਾ ਗਦਿਆਲਾ ਵਿਛਾਇਆ ਹੋਇਆ ਸੀ ਮੈਟਰਸ ਹੈ ਨਾ ਉਹ ਵਿਛਾਇਆ ਹੋਇਆ ਸੀਗਾ